ਇੱਕ ਵਧੀਆ ਪੋਰਟਰੇਟ ਆਪਣੇ ਮਨ ਦੇ ਭਾਵ ਪ੍ਰਗਟ ਕਰਦਾ ਹੈ ਆਪਣੇ ਦਿਲ ਦੀਆਂ ਭਾਵਨਾਵਾਂ ਪ੍ਰਗਟ ਕਰਦਾ ਉਹਦੇ ਜੋ ਮਨ ਵਿੱਚ ਚੱਲਦਾ ਹੁੰਦਾ ਹੈ ਜਾਂ ਦਿਲ ਵਿੱਚ ਕੀ ਆਉਂਦਾ ਹੁੰਦਾ ਹੈ ਉਹ ਆਪਣੇ ਪੋਰਟਰੇਟ 'ਤੇ ਉਕੇਰਦਾ ਹੈ ਉਹਦੇ ਆਸ ਪਾਸ ਆਪਣੇ ਉਹਦੇ ਸਮਾਜ ਵਿੱਚ ਕੀ ਚੱਲ ਰਿਹਾ ਜੋ ਰੂਟੀਨ ਦਾ ਜੋ ਚੱਲ ਰਿਹਾ ਉਹ ਆਪਣੇ ਪੋਰਟਰੇਟ 'ਤੇ ਵਿਅਕਤ ਕਰਦਾ ਮੈਂ ਉਸ ਤਰ੍ਹਾਂ ਦਾ ਪੋਟਰੇਟ ਬਣਾਵਾਂ ਕਿ ਲੋਕਾਂ ਨੂੰ ਜੀਵਨ ਦੇ ਨਾਲ ਜੁੜਿਆ ਹੋਇਆ ਜੀਵਨ ਸ਼ੈਲੀ ਦੇ ਨਾਲ ਜੁੜਿਆ ਹੋਇਆ ਪੋਰਟਰੇਟ ਬਣਾਵਾਂ ਇੱਕ ਦਿਲਚਸਪ ਪੋਰਟਰੇਟ ਲੈਣ ਲਈ ਇੱਕ ਤਾਂ ਦਿਨ ਦੀ ਰੌਸ਼ਨੀ ਵਿੱਚ ਬਨਾਉਣਾ ਚਾਹੀਦਾ ਹੈ ਕਿਉਂਕਿ ਰਾਤ ਦੀ ਰੋਸ਼ਨੀ ਵਿੱਚ ਇੱਕ ਪੋਟਰੇਟ ਵਧੀਆ ਨਹੀਂ ਬਣ ਸਕਦਾ ਇਸ ਲਈ ਦਿਨ ਦੀ ਰੌਸ਼ਨੀ ਵਿੱਚ ਤੁਹਾਨੂੰ ਬੜਾ ਹੀ ਅੱਛਾ ਵਿਊ ਮਿਲੂਗਾ ਔਰ ਜੋ ਧੁੱਪ ਦੀ ਰੋਸ਼ਨੀ ਹੁੰਦੀ ਉਦੋਂ ਕਰਕੇ ਜਿਹੜਾ ਪੋਰਟਰੇਟ ਤੁਸੀਂ ਬਣਾ ਰਹੇ ਹੋ ਅਤੇ ਤੁਸੀਂ ਰੰਗ ਕਰ ਰਹੇ ਹੋ ਅਤੇ ਉਹ ਰੰਗ ਵੀ ਜਲਦੀ ਸੁੱਕ ਗਏ ਔਰ ਜਲਦੀ ਹੀ ਵਧੀਆ ਤਰੀਕੇ ਨਾਲ ਇੱਕ ਪੋਰਟਰੇਟ ਬਣਾ ਸਕਦਾ ਹੈ ਇਸ ਲਈ ਹਮੇਸ਼ਾ ਪੋਰਟਰੇਟ ਬਣਾਉਣ ਲਈ ਦਿਨ ਦੀ ਰੌਸ਼ਨੀ ਦਾ ਪ੍ਰਯੋਗ ਕਰੋ ਨਾ ਕਿ ਸ਼ਾਮ ਨੂੰ ਜਾਂ ਰਾਤ ਨੂੰ ਪੋਰਟਰੇਟ ਬਣਾਓ ਇਸ ਲਈ ਪੋਰਟਰੇਟ ਹਮੇਸ਼ਾ ਦਿਨ ਦੀ ਰੌਸ਼ਨੀ ਵਿੱਚ ਹੀ ਬਣਾਉਣਾ ਚਾਹੀਦਾ